ਹੈਲੋ ਮੈਨੂੰ ਪੰਛੀਆਂ ਦੇ ਬਾਰੇ ਤੁਸ ਇਹ ਕੁਸ਼ਚਨ ਹੈ ਪੰਛੀ ਮੈਨੂੰ ਬਹੁਤ ਅੱਛੇ ਲੱਗਦੇ ਆ ਮੈਂ ਆਲਮੋਸਟ ਮਤਲਬ ਕਈ ਕੁ ਵਾਰੀ ਮਤਲਬ ਜਦੋਂ ਕਿਤੇ ਮੇਰਾ ਮਨ ਉਦਾਸ ਹੁੰਦਾ ਮੈਂ ਪੰਛੀਆਂ ਨੂੰ ਦਾਣਾ ਪਾਉਣ ਵੀ ਜਾਂਦੀ ਹਾਂ ਮੈਂ ਦੇਖਦੀ ਹਾਂ ਪੰਛੀ ਉੱਡਦੇ ਜਦੋਂ ਪਾਣੀ ਪੀਣ ਆਉਂਦੇ ਆ ਫਿਰ ਆਪਣਾ ਦਾਣਾ ਲੈ ਕੇ ਵਾਪਿਸ ਉੱਪਰ ਜਾਂਦੇ ਆ ਮੈਨੂੰ ਉਹ ਸੀਨ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਉਹਨਾਂ ਵਿੱਚ ਇੱਕ ਯੂਨਿਟੀ ਹੁੰਦੀ ਹੈ ਉਹ ਨੀਚੇ ਇਕੱਠੇ ਹੀ ਆਂਉਦੇ ਆ ਔਰ ਇਕੱਠੇ ਹੀ ਵਾਪਿਸ ਉੱਡਦੇ ਆ ਔਰ ਇੱਕ ਹੀ ਲਾਈਨ ਦੇ ਵਿੱਚ ਲਾਈਨ ਬਣਾ ਕੇ ਉਹ ਉੱਡਦੇ ਉਹਨਾਂ ਦਾ ਉਹਨਾਂ ਦਾ ਉਹ ਝੁੰਡ ਉਹ ਜਿਹੜੀ ਮਤਲਬ ਉਹਨਾਂ ਦੀ ਯੂਨਿਟੀ ਆ ਔਰ ਉਹਨਾਂ ਦਾ ਜਿਹੜਾ ਕਹਿ ਦਓ ਕਿ ਉਹ ਅਨੁਸ਼ਾਸਨ ਆ ਇੱਕ ਲਹਿਰ ਦੇ ਵਿੱਚ ਇੱਕ ਲਾਈਨ ਦੇ ਵਿੱਚ ਉਹ ਸਾਰੇ ਹੀ ਜਾਂਦੇ ਇੱਕ ਦੂਸਰੇ ਦੀ ਇਸ਼ਾਰੇ ਨੂੰ ਸਮਝਦੇ ਉਹ ਚੀਜ਼ ਮੈਨੂੰ ਉਹਨਾਂ ਦੀ ਬਹੁਤ ਅੱਛੀ ਲੱਗੀ ਹੈ ਪਰ ਇਹਨਾਂ ਦਾ ਜਿਹੜਾ ਵਖਰੇਵਾਂ ਆਪਾਂ ਕਹਿ ਸਕਦੇ ਹਾਂ ਇਹ ਮੈਂ ਇੱਕ ਵਾਰ ਦੇਖਿਆ ਮੈਂ ਆਪਣੀ ਕਿਸੇ ਨੋਨ ਦੇ ਘਰ ਗਈ ਸੀ ਤਾਂ ਉੱਥੇ ਮੈਂ ਦੇਖਿਆ ਕਿ ਉਹਨਾਂ ਦਾ ਇੱਕ ਤੋਤਾ ਆ ਉਹ ਬੋਲਦਾ ਸੀ ਮੈਨੂੰ ਬਹੁਤ ਮੈਂ ਮੈਂ ਅੱਜ ਤੋਂ ਪਹਿਲਾਂ ਮੈਂ ਕਦੇ ਵੀ ਮਤਲਬ ਗੱਲਾਂ ਕਰਨ ਵਾਲਾ ਤੋਤਾ ਨਹੀਂ ਸੀ ਦੇਖਿਆ ਮੈਂ ਫਸਟ ਟਾਈਮ ਉਸ ਤੋਤੇ ਨੂੰ ਦੇਖਿਆ ਤਾਂ ਮੈਨੂੰ ਉਹਨੂੰ ਦੇਖ ਕੇ ਬਹੁਤ ਮਤਲਬ ਅਜੀਬ ਲੱਗਿਆ ਕਿ ਜਿਵੇਂ ਅਸੀਂ ਬੋਲਦੇ ਹਾਂ ਇਨਸਾਨਾਂ ਦੀ ਤਰ੍ਹਾਂ ਕਿ ਇੱਕ ਪਕਸ਼ੀ ਹੋ ਗਈ ਤੋਤਾ ਜਿਹੜਾ ਉਵੇਂ ਬੋਲ ਰਿਹਾ ਮੈਂ ਜੋ ਜੋ ਚੀਜ਼ ਬੋਲਦੀ ਸੀ ਜੋ ਚੀਜ਼ ਮੈਂ ਰਿਪੀਟ ਕਰਦੀ ਸੀ ਉਹ ਹੀ ਮੇਰੇ ਪਿੱਛੇ ਪਿੱਛੇ ਬੋਲਦਾ ਸੀ ਜਿਵੇਂ ਮੈਂ ਬੋਲਦੀ ਸੀ ਮਿੱਠੂ ਰਾਮ ਚੂਰੀ ਖਾਣੀ ਆ ਉਹ ਵੀ ਸੇਮ ਬੋਲਦਾ ਸੀ ਮਿੱਠੂ ਚੂਰੀ ਖਾਣੀ ਆ ਮਿੱਠੂ ਜਿਵੇਂ ਉਹਦਾ ਨਾਮ ਲੈਂਦੇ ਸੀ ਉਵੇਂ ਹੀ ਉਹ ਆਪਣੇ ਨਾਮ ਨੂੰ ਪਿੱਛੇ ਪਿੱਛੇ ਰਿਪੀਟ ਕਰਦਾ ਸੀ ਠੀਕ ਹੈ ਬਾਰ ਬਾਰ ਬਾਰ ਬਾਰ ਬੋਲਦਾ ਸੀ ਤਾਂ ਉਹ ਚੀਜ਼ ਦੇਖ ਕੇ ਬੜਾ ਅੱਛਾ ਲੱਗਿਆ ਬੜਾ ਮਤਲਬ ਅਲੱਗ ਵੀ ਲੱਗਿਆ ਕਿ ਕੀ ਇਸ ਤਰ੍ਹਾਂ ਹੀ ਮਤਲਬ ਮੈਨੂੰ ਆਪਣੀਆਂ ਅੱਖਾਂ 'ਤੇ ਆਪਣੀਆਂ ਕੰਨਾਂ 'ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਵਾਕਿਆ ਹੀ ਇਸ ਤਰ੍ਹਾਂ ਵੀ ਹੋ ਸਕਦਾ ਆ ਕਿ ਕੋਈ ਪੰਛੀ ਵੀ ਇਨਸਾਨਾਂ ਦੀ ਤਰ੍ਹਾਂ ਬੋਲ ਸਕਦਾ ਆ ਤਾਂ ਮੈਨੂੰ ਉਹ ਕਹਿ ਦਓ ਕਿ ਮੈਨੂੰ ਸੀਨ ਅੱਛਾ ਵੀ ਲੱਗਿਆ ਔ ਔਰ ਮੈਨੂੰ ਉਹ ਯਾਦ ਮਤਲਬ ਹਮੇਸ਼ਾ ਰਹਿੰਦਾ ਆ ਅਤੇ ਕਦੇ ਵੀ ਜਦੋਂ ਮੇਰਾ ਬਾਰ ਬਾਰ ਦਿਲ ਕਰਦਾ ਆ ਉਸਦੀ ਆਵਾਜ਼ ਸੁਣਨ ਨੂੰ ਤਾਂ ਮੈਂ ਉਹਨਾਂ ਦੇ ਘਰ ਚਲੇ ਜਾਂਦੀ ਹਾਂ ਬਟ ਉਹ ਮੈਂ ਜ਼ਿਆਦਾ ਨਹੀਂ ਜਾ ਪਾਉਂਦੀ ਮੈਂ ਕਈ ਵਾਰ ਉਹਨਾਂ ਨੂੰ ਫੋਨ ਕਾਲ 'ਤੇ ਮਤਲਬ ਗੱਲ ਕਰਦੀ ਆ ਵੀਡੀਓ ਕਾਲ 'ਤੇ ਤਾਂ ਮੈਂ ਕਹਿੰਦੀ ਮੈਨੂੰ ਇੱਕ ਵਾਰ ਇਹਨਾਂ ਦੀ ਆਵਾਜ਼ ਸੁਣਾ ਦਿਓ ਕਿਉਂਕਿ ਉਹ ਮੇਰੇ ਤੋਂ ਦੂਰ ਰਹਿੰਦੇ ਨੇ ਠੀਕ ਹੈ ਮੈਂ ਲੁਧਿਆਣਾ ਸ਼ਹਿਰ ਵਿੱਚ ਰਹਿੰਦੀ ਹਾਂ ਉਹ ਫ਼ਾਜ਼ਿਲਕਾ ਰਹਿੰਦੇ ਨੇ ਸੋ ਮੈਂ ਟਾਈਮ ਟੂ ਟਾਈਮ ਨਹੀਂ ਮਤਲਬ ਡੇ ਬਾਏ ਡੇਜ ਜਾ ਰੋਜ਼ ਕਹਿ ਦਓ ਕੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਨਹੀਂ ਨਿਕਲਿਆ ਜਾਂਦਾ ਪਰ ਜਦੋਂ ਵੀ ਕਦੇ ਮੇਰਾ ਦਿਲ ਕਰਦਾ ਹੈ ਤਾਂ ਮੈਂ ਵੀਡੀਓ ਕਾਲ ਕਰਕੇ ਉਹਨਾਂ ਦੇ ਮਿੱਠੂ ਨਾਲ ਜ਼ਰੂਰ ਗੱਲ ਕਰ ਲੈਂਦੀ ਹਾਂ ਇਹ ਮੇਰੀ ਛੋਟੀ ਜਿਹੀ ਯਾਦ ਸੀ ਜੋ ਮੈਂ ਤੁਹਾਡੇ ਨਾਲ ਸਾਂਝੀ ਕੀਤੀ